ਹੈਲੋ ਹੈਲੋ ਹਾਂਜੀ ਮੈਂ ਦੀਪਿਕਾ ਗੱਲ ਕਰਦੀ ਪਈ ਹਾਂ ਹਾਂਜੀ ਹਾਂਜੀ ਨਮਸਕਾਰ ਹਾਂਜੀ ਸਰ ਤੁਸੀਂ ਕੀ ਕਰਦੇ ਪਏ ਹੋ ਅੱਜ ਕੱਲ੍ਹ ਠੀਕ ਹੈ ਠੀਕ ਹੈ ਹਾਂਜੀ ਪਠਾਨਕੋਟ 'ਚ ਦੋ ਤਿੰਨ ਹੈਗੀਆਂ ਹੈਗੀਆਂ ਕਿਸੇ ਦੇ ਕੰਪਿਊਟਰ ਸ਼ੋਪ 'ਤੇ ਆ ਜਾਂ ਫਿਰ ਤੁਸੀਂ ਦੇਖ ਲਓ ਕਿ ਟੀਚਰ ਦੀ ਜੋਬ ਵੀ ਹੈ ਪ੍ਰਾਇਮਰੀ ਟੀਚਰ ਦੀ ਜੋਬ ਵੀ ਤੁਹਾਨੂੰ ਮਿਲ ਸਕਦੀ ਹੈ ਸੈਲਰੀ ਭਾਵੇਂ ਘੱਟ ਹੋਵੇਗੀ ਥੋੜ੍ਹੀ ਹਾਂ ਬਟ ਇਹ ਹੈ ਕਿ ਤੁਹਾਡਾ ਨਾਰਮਲ ਗੁਜ਼ਾਰਾ ਹੋ ਸਕਦਾ ਸੈਲਰੀ ਸੈਲਰੀ ਹਾਂਜੀ ਕੋਈ ਹੈ ਦਸ ਬਾਰਾਂ ਹਜ਼ਾਰ ਦੇ ਅੰਦਰ ਅੰਦਰ ਹੈਗੀ ਹੈ ਹਾਂਜੀ ਜੇ ਤਾਂ ਤੁਸੀਂ ਬਾਹਰ ਦੇ ਹੋ ਫਿਰ ਤੁਹਾਡੇ ਲਈ ਥੋੜ੍ਹਾ ਔਖਾ ਬਟ ਜੇ ਤੁਸੀਂ ਪਠਾਨਕੋਟ ਦੇ ਰਹਿਣ ਵਾਲੇ ਹੋ ਫਿਰ ਤੁਹਾਨੂੰ ਠੀਕ ਆ ਮਤਲਬ ਤੁਹਾਡੇ ਹਿਸਾਬ ਨਾਲ ਸਹੀ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੇ ਨਹੀਂ ਉਹ ਵੀ ਸਹੀ ਹੈ ਬਟ ਹੁਣ ਜਿੱਦਾਂ ਮੋਲ ਦਾ ਇਹ ਆ ਨਾ ਕਿ ਤੁਸੀਂ ਸਾਰਾ ਦਿਨ ਉੱਥੇ ਲੱਗੇ ਰਹੋਗੇ ਅਤੇ ਟੀਚਿੰਗ ਦੀ ਲਾਈਨ ਦਾ ਇਹ ਹੈ ਕਿ ਜੇ ਤੁਸੀਂ ਮਤਲਬ ਨਾਈਨ ਟੂ ਦੋ ਵਜੇ ਤੱਕ ਜੋਬ ਹੋਣੀ ਆ ਤੁਹਾਡੀ ਉੱਥੇ ਥੋੜ੍ਹਾ ਠੀਕ ਰਹਿਣਾ ਵੈਸੇ ਹਾਂਜੀ ਤੁਸੀਂ ਹਾਂਜੀ ਤੁਸੀਂ ਦੇਖ ਲਓ ਆਪਣੇ ਹਿਸਾਬ ਨਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਨਾ ਉੱਥੇ ਛੇ ਘੰਟੇ ਜੇ ਤੁਸੀਂ ਲਗਾਓਗੇ ਵੀ ਤਾਂ ਠੀਕ ਆ ਉਹ ਵੀ ਦਸ ਬਾਰਾਂ ਹਜ਼ਾਰ 'ਚ ਜੇ ਮਿਲਦੀ ਪਈ ਹੈ ਜੋਬ ਹਾਂਜੀ ਹਾਂਜੀ ਹਾਂਜੀ ਠੀਕ ਹੈ ਓਕੇ ਓਕੇ ਓਕੇ